ਵਿਗਿਆਨ ਅਤੇ ਟੈਕਨੋਲਜੀ ਵਿੱਚ ਤਰੱਕੀ ਨੇ ਸਿਹਤ ਸੰਭਾਲ ਖੇਤਰ ਵਿੱਚ ਬਹੁਤ ਸਹੂਲਤ ਦਿੱਤੀ ਹੈ ਜਿਵੇਂ ਕਿ ਕੋਵਿਡ ਐਪ ਹੈ ਜਿਸ ਨਾਲ ਜਿਸ ਐਪ ਨੂੰ ਡਾਊਨਲੋਡ ਕਰਨ 'ਤੇ ਸਾਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਕਿਹੜਾ ਖੇਤਰ ਡੇਂਜਰ ਜ਼ੋਨ 'ਚ ਹੈ ਅਤੇ ਕਿਹੜਾ ਗਰੀਨ ਜ਼ੋਨ 'ਚ ਹੈ ਅਤੇ ਇਸ ਐਪ ਥਰੂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਸੀ ਕਿ ਕੋਵਿਡ ਦੌਰਾਨ ਅਸੀਂ ਆਪਣੀ ਕਿਵੇਂ ਸਾਂਭ ਸੰਭਾਲ ਕਰਨੀ ਹੈ ਕਿ ਅਸੀਂ ਕਿਵੇਂ ਇਸ ਬਿਮਾਰੀ ਤੋਂ ਬਚ ਸਕਦੇ ਨੇ ਅਤੇ ਆਪਣੀ ਸਾਂਭ ਸੰਭਾਲ ਕਰ ਸਕਦੇ ਨੇ ਉਸ ਤੋਂ ਇਲਾਵਾ ਇਸ ਐਪ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸਾਨੂੰ ਬਚਾਇਆ ਹੈ